ਮੈਂ ਮੋਬਾਇਲ 'ਤੇ ਥੋੜ੍ਹਾ ਬਹੁਤ ਫੇਸਬੁੱਕ ਚਲਾ ਲੈਂਦੀ ਹਾਂ ਟਵਿੱਟਰ ਅਤੇ ਇਸਟਾਗ੍ਰਾਮ ਮੈਨੂੰ ਚਲਾਉਣਾ ਨਹੀਂ ਆਉਂਦਾ ਲਾਲ ਬਿੰਦੀ ਵਾਲਾ ਯੂਟਿਊਬ ਹੁੰਦਾ ਹੈ ਉਹ ਵੀ ਮੈਂ ਥੋੜ੍ਹਾ ਬਹੁਤ ਵੇਖ ਲੈਂਦੀ ਹਾਂ ਉਸ ਵਿੱਚ ਲੋਕਾਂ ਨੇ ਆਪਣੀ ਬਹੁਤ ਸਾਰੀਆਂ ਵੀਡੀਓ ਪਾਈਆਂ ਹੁੰਦੀਆਂ ਹਨ ਫੇਸਬੁੱਕ 'ਤੇ ਵੀ ਬਹੁਤ ਸਾਰੇ ਲੋਕ ਆਪ ਅਤੇ ਆਹ ਚੈਨਲਾਂ ਵਾਲੇ ਵੀ ਆਪਣੀਆਂ ਵੀਡੀਓ ਪਾਉਂਦੇ ਹਨ ਯੂਟਿਊਬ 'ਤੇ ਵੀ ਲੋਕ ਆਪਣੀਆਂ ਵੀਡੀਓ ਪਾਉਂਦੇ ਹਨ ਇਹਨਾਂ ਵੀਡੀਓ ਵਿੱਚ ਕਈ ਚੰਗੀਆਂ ਅਤੇ ਕਈ ਝੂਠੀਆਂ ਖ਼ਬਰਾਂ ਵੀ ਹੁੰਦੀਆਂ ਹਨ ਕਈ ਲੋਕ ਆਪਣੇ ਵਿਊ ਵਧਾਉਣ ਵਾਸਤੇ ਪੁਰਾਣੀਆਂ ਖ਼ਬਰਾਂ ਜਾਂ ਝੂਠੀਆਂ ਖ਼ਬਰਾਂ ਤਰੋੜ ਮਰੋੜ ਕੇ ਅ ਪਾਉਂਦੇ ਹਨ ਅਸੀਂ ਵੇਖ ਕੇ ਟਾਈਮ ਪਾਸ ਕਰ ਲੈਂਦੇ ਹਾਂ ਪਰ ਗੱਲਬਾਤ ਕੋਈ ਨਹੀਂ ਹੁੰਦੀ ਵਿੱਚ ਕਈ ਖ਼ਬਰਾਂ ਵਾਲੇ ਚੈਨਲ ਵੀ ਹੁੰਦੇ ਹਨ ਉਹਨਾਂ ਦੀ ਖ਼ਬਰ ਅਤੇ ਗੱਲਾਂ ਧਿਆਨ ਨਾਲ ਸੁਣ ਲਈ ਦੀਆਂ ਹਨ ਕਈ ਲੋ ਕਈ ਉੱਘੇ ਲੋਕਾਂ ਦੀ ਇੰਟਰਵਿਊ ਵੀ ਹੁੰਦੀ ਹੈ ਉਹ ਵੀ ਕਈ ਵਾਰੀ ਬਹੁਤ ਧਿਆਨ ਨਾਲ ਵੇਖੀ ਵੇਖ ਲਈ ਦੀ ਹੈ ਅਤੇ ਨਾਲੇ ਗੱਲਾਂ ਸੁਣ ਲਈ ਦੀਆਂ ਹਨ ਭਰੋਸੇਯੋਗ ਸ੍ਰੋਤ ਅਤੇ ਫੇਸਬੁੱਕ ਚੈਨਲ ਬਹੁਤ ਹੀ ਘੱਟ ਹੁੰਦੇ ਹਨ